ਹਾਂਜੀ ਬਿਲਕੁਲ ਮੈਂ ਸਫ਼ਰ ਕਰਦੀ ਰਹਿੰਦੀ ਹਾਂ ਖਾਸ ਕਰ ਹੁਣ ਜਿਵੇਂ ਸਪੈਸ਼ਲੀ ਪਟਿਆਲਾ ਤੋਂ ਅੰਮ੍ਰਿਤਸਰ ਦਰਬਾਰ ਸਾਹਿਬ ਮੱਥਾ ਟੇਕਣ ਜਾਣਾ ਹੋਵੇ ਤਾਂ ਟ੍ਰੇਨ ਦੇ ਵਿੱਚ ਵੀ ਬੱਸ ਦੇ ਉੱਪਰ ਵੀ ਤਾਂ ਮੇਰਾ ਸਫ਼ਰ ਚੱਲਦਾ ਹੀ ਰਹਿੰਦਾ ਹੈ ਤਾਂ ਇਸ ਤੋਂ ਬਿਨਾਂ ਹੈ ਕਿ ਜੇਕਰ ਸਫ਼ਰ ਦੇ ਐਕਸਪੀਰੀਅੰਸ ਅਨੁਭਵ ਨੂੰ ਦੱਸਿਆ ਜਾਵੇ ਤਾਂ ਸਫ਼ਰ ਕਰਨਾ ਟਰੈਵਲਿੰਗ ਮੈਨੂੰ ਵਧੀਆ ਲੱਗਦਾ ਹੈ ਤਾਂ ਉਹਦੇ ਵਿੱਚ ਨਾਲ ਮੈਂ ਕੁਛ ਨਾ ਕੁਛ ਰੀਡਿੰਗ ਦੇ ਲਈ ਕੋਈ ਨਾ ਕੋਈ ਬੁੱਕ ਲਈ ਹੁੰਦੀ ਆ ਟ੍ਰੇਨ ਦੇ ਵਿੱਚ ਵੀ ਜੇਕਰ ਸਫ਼ਰ ਕਰਦੇ ਹਾਂ ਤਾਂ ਉਹ ਜਾਂਦੇ ਹੋਏ ਟ੍ਰੈਵਲਿੰਗ ਕਰਦੇ ਹੋਏ ਪੜ੍ਹਦੇ ਜਾਓ ਨਾਲ ਨਾਲ ਨਵੇਂ ਮੁਸਫ਼ਿਰ ਮਿਲਦੇ ਨੇ ਉਹਨਾਂ ਨਾਲ ਗੱਲਾਂ ਬਾਤਾਂ ਕਰਦੇ ਜਾਓ ਤਾਂ ਇਸ ਤਰੀਕੇ ਦੇ ਨਾਲ ਸਫ਼ਰ ਦਾ ਅਨੁਭਵ ਮੇਰਾ ਬਹੁਤ ਵਧੀਆ ਰਹਿੰਦਾ ਹੈ